ਵੈਸੇ ਅਸੀਂ ਕਿਸੇ ਇੱਕ ਕਿਤਾਬ ਨੂੰ ਮਨਪਸੰਦ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਵੱਖ ਵੱਖ ਕਿਤਾਬਾਂ ਵਿੱਚ ਵੱਖ ਵੱਖ ਮੁੱਦਿਆਂ ਘਟਨਾਵਾਂ ਬਾਰੇ ਪੜ੍ਹਦੇ ਹਾਂ ਵੱਖ ਵੱਖ ਕਿਤਾਬਾਂ ਰਾਹੀਂ ਵੱਖ ਵੱਖ ਸਮਾਜਿਕ ਸਮੱਸਿਆਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਪਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਲਾਲ ਬੱਤੀ ਨੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਇਸ ਨਾਵਲ ਵਿੱਚ ਲੇਖਕ ਨੇ ਬਸਤੀ ਵਿੱਚ ਜਾਂ ਹੋ ਰਹੀਆਂ ਦਿੱਲੀ ਦੀਆਂ ਵੇਸ਼ਵਾਵਾਂ ਨਾਲ ਧੱਕੇਸ਼ਾਹੀ ਵਿਤਕਰੇ ਆਦਿ ਬਾਰੇ ਵਿਆਖਿਆ ਕਰੀ ਹੈ ਲੇਖਕ ਨੇ ਉਸ ਬਸਤੀ ਵਿੱਚ ਆਪ ਜਾ ਕੇ ਆਪਣੀ ਅੱਖਾਂ ਸਾਹਮਣੇ ਵਾਪਰੀਆਂ ਘਟਨਾਵਾਂ ਨੂੰ ਚਿਤਰਿਆ ਹੈ ਇਸ ਨਾਵਲ ਵਿੱਚ ਵੇਸ਼ਵਾਵਾਂ ਅਤੇ ਉਹਨਾਂ ਔਰਤਾਂ ਜੋ ਇਸ ਧੰਦੇ ਵਿੱਚ ਜਾਣ ਲਈ ਮਜਬੂਰ ਹੋਈਆਂ ਉਹਨਾਂ ਦੀਆਂ ਘਟਨਾਵਾਂ ਅਤੇ ਉਹਨਾਂ ਦੀਆਂ ਦੁੱਖ ਦਰਦ ਪੀੜਾਂ ਨੂੰ ਇੱਕ ਸੰਜਮ ਤੌਰ 'ਤੇ ਪੇਸ਼ ਕੀਤਾ ਹੈ ਇਹ ਨਾਵਲ ਵਿੱਚ ਔਰਤਾਂ ਦੀ ਐਸੀ ਸਥਿਤੀ ਨੂੰ ਬਿਆਨ ਕਰਨ ਵਾਲਾ ਨਾਵਲਕਾਰ ਬਹੁਤ ਹੀ ਸੰਵੇਦਨਸ਼ੀਲ ਅਤੇ ਬਹੁਤ ਹੀ ਭਾਵੁਕਤਾ ਨਾਲ ਪੇਸ਼ ਕਰਦਾ ਹੈ ਇਸ ਨਾਵਲ ਨੂੰ ਪੜ੍ਹਨ ਲਈ ਮੈਂ ਆਪਣੇ ਵੱਖ ਵੱਖ ਦੋਸਤਾਂ ਮਿੱਤਰਾਂ ਨੂੰ ਕਹਿੰਦਾ ਹਾਂ ਤਾਂ ਕਿ ਔਰਤਾਂ ਦੀ ਉਸ ਸਥਿਤੀ ਬਾਰੇ ਸਾਰੇ ਹੀ ਜਾਣ ਸਕਣ ਅਤੇ ਉਹਨਾਂ ਉੱਪਰ ਮੁੱਦਾ ਬਣਾਉਣ ਜਾਂ ਉਸ ਸਮੱਸਿਆ ਨੂੰ ਸੁਧਾਰਨ ਜਾਂ ਉਸ ਦਾ ਨਿਵਾਰਨ ਕਰਨ ਲਈ ਆਪਣੀ ਆਵਾਜ਼ ਚੱਕ ਸਕਣ